ਆਮ ਨਾਗਰਿਕਾਂ ਦੀ ਸੁਰੱਖਿਆ ਲਈ ਕਾਨੂੰਨੀ ਪ੍ਰਣਾਲੀ ਵਿੱਚ ਬਹੁਤ ਸੁਧਾਰ ਕਰਨ ਦੀ ਲੋੜ ਹੈ ਜਦੋਂ ਵੀ ਕਿਤੇ ਕੋਈ ਵਾਰਦਾਤ ਹੁੰਦੀ ਹੈ ਇੱਕ ਤਾਂ ਪੁਲਿਸ ਵਾਲੇ ਜਾਂ ਕੋਈ ਵੀ ਕਾਨੂੰਨ ਵਿਵਸਥਾ ਹੈ ਬਹੁਤ ਲੇਟ ਪਹੁੰਚਦੀ ਹੈ ਕਿਤੇ ਵੀ ਐਕਸੀਡੈਂਟ ਹੁੰਦਾ ਸਭ ਤੋਂ ਪਹਿਲਾਂ ਜੋ ਐਬੂਲੈਂਸ ਹੈ ਉਸਨੂੰ ਰਾਹ ਦੇਣਾ ਚਾਹੀਦਾ ਹੈ ਕਾਨੂੰਨ ਦੀ ਪੂਰੀ ਜਿੰਮੇਵਾਰੀ ਬਣਦੀ ਹੈ ਕਿ ਜਦੋਂ ਵੀ ਕੋਈ ਇਹੇ ਜਿਹੀ ਵਾਰਦਾਤ ਸ਼ਹਿਰ ਦੇ ਵਿੱਚ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਬਿਨ੍ਹਾਂ ਰਿਸ਼ਵਤ ਲਏ ਤੋਂ ਉਸ ਸਮੱਸਿਆਂ ਦਾ ਹੱਲ ਕੀਤਾ ਜਾਣਾ ਚਾਹੀਦਾ ਔਰ ਜਿਹੜੇ ਨਵੇਂ ਨੌਜਵਾਨ ਹੈ ਉਹਨਾਂ ਨੂੰ ਖੇਡਾਂ ਪ੍ਰਤੀ ਸਪੋਰਟਸ ਪ੍ਰਤੀ ਔਰ ਐਜੂਕੇਸ਼ਨ ਦੇ ਪ੍ਰਤੀ ਵਿੱਦਿਆ ਦੇ ਪ੍ਰਤੀ ਪੂਰੇ ਸੁਚਾਰੂ ਢੰਗ ਦੇ ਨਾਲ਼ ਉੱਚ ਵਿੱਦਿਆ ਹਾਸਿਲ ਕਰਕੇ ਬੜੇ ਅਫ਼ਸਰ ਸ਼ਾਹੀ ਨੌਕਰੀਆਂ 'ਤੇ ਲੱਗਣਾ ਚਾਹੀਦਾ ਜੋ ਕਿ ਆਪਣੇ ਦੇਸ਼ ਦੀ ਸਰਕਾਰ ਹੈ ਜੋ ਉਹਦੀ ਕਾਨੂੰਨ ਵਿਵਸਥਾ ਵਧੀਆ ਤਰੀਕੇ ਨਾਲ਼ ਚਲਾਈ ਜਾ ਸਕੇ ਹੋਰ ਵੀ ਇਸ ਵਿੱਚ ਆਪਾਂ ਐਡ ਕਰ ਸਕਦੇ ਹਾਂ ਜਿਵੇਂ ਕਿ ਸਮਾਜ ਸੇਵਾ ਦੇ ਕੰਮ ਆਮ ਨਾਗਰਿਕ ਦਾ ਵੀ ਆਹ ਫਰਜ਼ ਬਣਦਾ ਕਿ ਉਹ ਪੁਲਿਸ ਦਾ ਕਾਨੂੰਨੀ ਵਿਵਸਥਾ ਦਾ ਸਾਥ ਦੇਵੇ ਜੋ ਕਿ ਆਪਣਾ ਦੇਸ਼ ਹੈ ਉਹ ਤਰੱਕੀ ਕਰ ਸਕੇ